ਇਹ ਗੱਲ ਸੱਚ ਹੈ ਕਿ ਜਿਹੜੀਆਂ ਪੁਰਾਣੀਆਂ ਪੀੜ੍ਹੀਆਂ ਹਨ ਉਹ ਅੱਜ ਕੱਲ੍ਹ ਦੀਆਂ ਜਿਹੜੀਆਂ ਨੌਜਵਾਨ ਪੀੜ੍ਹੀਆਂ ਹਨ ਨਵੀਆਂ ਪੀੜ੍ਹੀਆਂ ਹਨ ਉਹਨਾਂ ਤੋਂ ਜ਼ਿਆਦਾ ਧਾਰਮਿਕ ਹੁੰਦੀਆਂ ਸਨ ਕਿਉਂਕਿ ਪੁਰਾਣੇ ਟਾਈਮ ਦੇ ਯੁੱਗ ਵਿੱਚ ਜਿਹੜੇ ਲੋਕ ਸੀ ਉਹ ਧਰਮ ਨਾਲ ਜ਼ਿਆਦਾ ਜੁੜੇ ਹੋਏ ਹੁੰਦੇ ਸਨ ਅਤੇ ਜਦੋਂ ਧਾਰਮਿਕ ਗਤੀਵਿਧੀਆਂ ਵੀ ਜ਼ਿਆਦਾ ਕਰਾਈਆਂ ਜਾਂਦੀਆਂ ਸਨ ਅਤੇ ਲੋਕ ਉਦੋਂ ਰੱਬ ਤੋਂ ਬਹੁਤ ਜ਼ਿਆਦਾ ਡਰਦੇ ਸਨ ਅਤੇ ਰੱਬ ਦੀ ਬਹੁਤ ਜ਼ਿਆਦਾ ਬੰਦਗੀ ਕਰਦੇ ਸਨ ਪਰ ਅੱਜ ਕੱਲ੍ਹ ਦੇ ਮੌਡਰਨ ਜ਼ਮਾਨੇ ਦੇ ਵਿੱਚ ਜਿਹੜੀ ਕਿ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੇ ਉਹ ਘੱਟਦੀਆਂ ਜਾ ਰਹੀਆਂ ਨੇ ਅਤੇ ਅੱਜ ਕੱਲ੍ਹ ਦੇ ਜਿਹੜੇ ਲੋਕ ਨੇ ਉਹ ਧਰਮ ਵੱਲ ਇੰਨਾਂ ਧਿਆਨ ਨਹੀਂ ਦਿੰਦੇ ਲੋਕਾਂ ਆਪਦੇ ਮਜ਼ੇ ਲਈ ਇੱਧਰ ਉੱਧਰ ਚੀਜ਼ਾਂ ਕਰਦੇ ਹਨ ਅਤੇ ਜਾਂ ਹੋਰ ਅਜਿਹੀਆਂ ਚੀਜ਼ਾਂ ਕਰਦੇ ਹਨ ਜੋ ਕਿ ਧਾਰਮਿਕ ਪੱਖਾਂ ਦੇ ਖਿਲਾਫ ਹੁੰਦੀਆਂ ਹਨ ਅਤੇ ਜਿਹਦੇ ਕਰਕੇ ਲੋਕ ਜਿਹੜੇ ਹੈਗੇ ਆ ਉਹ ਧਰਮਾਂ ਨੂੰ ਛੱਡ ਕੇ ਹੋਰ ਪਾਸੇ ਧਿਆਨ ਲਾ ਰਹੇ ਹਨ ਅਤੇ ਜਿਹਦੇ ਕਰਕੇ ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਉਹ ਧਰਮਾਂ ਤੋਂ ਦੂਰ ਜਾ ਰਹੀ ਹੈ ਅਤੇ ਇਹਦੇ ਕੁਛ ਮਾੜੇ ਪੱਖ ਇਹ ਹਨ ਕਿ ਜਦੋਂ ਲੋਕ ਧਰਮਾਂ ਤੋਂ ਦੂਰ ਜਾ ਰਹੇ ਹਨ ਤਾਂ ਜਿਹੜਾ ਧਰਮ ਹੈ ਉਹ ਆਪਾਂ ਨੂੰ ਇੱਕ ਚੰਗਾ ਇਨਸਾਨ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਪਰ ਜਿਹੜੇ ਲੋਕ ਹਨ ਉਹ ਧਰਮ ਤੋਂ ਦੂਰ ਜਾ ਰਹੇ ਹਨ ਜਿਹਦੇ ਕਰਕੇ ਅੱਜ ਕੱਲ੍ਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਅਜਿਹੀਆਂ ਭਾਵਨਾਵਾਂ ਦੇਖਣ ਨੂੰ ਮਿਲਦੀਆਂ ਹਨ ਜਿਹੜੀਆਂ ਕਿ ਬਹੁਤ ਜਿਹੜੇ ਲੋਕ ਨੇ ਅੱਜ ਕੱਲ੍ਹ ਬਹੁਤ ਜ਼ਿਆਦਾ ਗੁੱਸਾ ਕਰਦੇ ਨੇ ਲੋਕ ਆਪਸ ਦੇ ਵਿੱਚ ਈਰਖਾ ਕਰਦੇ ਹਨ ਜਿਹਦੇ ਕਰਕੇ ਜਿਹੜੇ ਲੋਕ ਨੇ ਉਹ ਆਪਸ ਦੇ ਵਿੱਚ ਟੁੱਟਦੇ ਜਾ ਰਹੇ ਹਨ ਅਤੇ ਧਰਮ ਸਭ ਨੂੰ ਜੋੜ ਕੇ ਰੱਖਦਾ ਹੈ ਅਤੇ ਜਿਹੜੇ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਧਰਮ ਦੇ ਬਿਲਕੁਲ ਉਲਟ ਚੱਲਦੀ ਹੈ ਅਤੇ ਜਿਹਦੇ ਕਰਕੇ ਅੱਜ ਕੱਲ੍ਹ ਲੋਕ ਆਪਦੀਆਂ ਸਮਾਜਿਕ ਸਥਿਤੀਆਂ ਨਾਲੋਂ ਟੁੱਟਦੇ ਜਾ ਰਹੇ ਹਨ